ਪਹਿਲਾਂ ਖੁੱਲ੍ਹੇ ਵਿੱਚ ਟੋਇਲੇਟ ਕਰਨਾ ਬਹੁਤ ਆਮ ਗੱਲ ਸੀ ਪਰ ਹੁਣ ਆਮ ਗੱਲ ਨਹੀਂ ਹੈ ਹੁਣ ਹਰੇਕ ਘਰ ਵਿੱਚ ਸੈਪਰੇਟ ਟੋਇਲੇਟ ਬਣਾ ਲਏ ਹਨ ਅਤੇ ਜੇ ਅਤੀ ਜੇ ਅਸੀਂ ਪਬਲਿਕ ਪਲੇਸ ਵਿੱਚ ਕਿਤੇ ਅੰਦਰ ਬਾਹਰ ਵੀ ਜਾਂਦੇ ਹਾਂ ਤਾਂ ਪਬਲਿਕ ਟੋਇਲੇਟ ਬਣ ਚੁੱਕੇ ਹਨ ਜਿਸ ਦੀ ਅਸੀਂ ਵਰਤੋਂ ਕਰ ਸਕਦੇ ਹਾਂ ਅਤੇ ਪਹਿਲਾਂ ਇਹ ਬਹੁਤ ਆਮ ਗੱਲ ਸੀ ਬਾਹਰ ਟੋਇਲੇਟ ਕਰਨਾ ਪਰ ਹੁਣ ਇਹ ਆਮ ਗੱਲ ਨਹੀਂ ਹੈ ਜਦੋਂ ਅਸੀਂ ਹੁਣ ਬਾਹਰ ਕਿਤੇ ਵੀ ਟੋਇਲੇਟ ਕਰਦੇ ਹਾਂ ਤਾਂ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਅਤੇ ਉੱਥੇ ਲੰਘਣ ਵਾਲੇ ਨੂੰ ਵੀ ਦਿੱਕਤ ਆਉਂਦੀ ਹੈ ਅਤੇ ਲੇਡੀਜ ਨੂੰ ਸਮੈਲ ਸਮੈਲ ਆਉਂਦੀ ਹੈ ਅਤੇ ਇਸ ਕਰਕੇ ਅੰਦਰ ਬਾਹਰ ਦੇਖਣ ਵਾਲੇ ਨੂੰ ਵੀ ਬਹੁਤ ਬੁਰਾ ਲੱਗਦਾ ਹੈ ਅਤੇ ਇਸ ਕਰਕੇ ਹੁਣ ਇਹ ਆਮ ਗੱਲ ਨਹੀਂ ਹੈ ਪਹਿਲਾਂ ਬਹੁਤ ਆਮ ਗੱਲ ਸੀ ਅਤੇ ਜ਼ਿਆਦਾਤਰ ਇਸਦੀ ਵਰਤੋਂ ਪਹਿਲਾਂ ਪਿੰਡਾਂ ਵਿੱਚ ਕੀਤੀ ਜਾਂਦੀ ਸੀ ਅਤੇ ਹੁਣ ਬਾਹਰ ਕੋਈ ਵੀ ਟੋਇਲੇਟ ਨਹੀਂ ਕਰਦਾ ਕਿਉਂਕਿ ਹਰੇਕ ਕੋਲ ਆਪਣੇ ਟੋਇਲੇਟ ਘਰ ਵਿੱਚ ਹਨ ਅਤੇ ਜਦੋਂ ਅਸੀਂ ਕਿਤੇ ਵੀ ਜਾਂਦੇ ਹਾਂ ਤਾਂ ਹੁਣ ਸਾਨੂੰ ਐਵੇਂ ਕੁਝ ਵੀ ਦੇਖਣ ਨੂੰ ਨਹੀਂ ਮਿਲਦਾ ਕਿਉਂਕਿ ਇਹ ਸਾਰਾ ਕੁਝ ਹੁਣ ਬਹੁਤ ਸਹੀ ਹੋ ਚੁੱਕਿਆ ਹੈ ਜਿਵੇਂ ਪਹਿਲਾਂ ਵਾਤਾਵਰਨ ਪ੍ਰਦੂਸ਼ਿਤ ਕਰਦੇ ਸੀ ਹੁਣ ਐਵੇਂ ਦਾ ਕੁਝ ਨਹੀਂ ਹੁੰਦਾ ਹੁਣ ਸਾਰਾ ਕੁਝ ਬਹੁਤ ਸਹੀ ਹੁੰਦਾ ਹੈ ਜਿਵੇਂ ਕਿ ਪ ਲਿਕ ਟੋਇਲਟ ਨੂੰ ਅਸੀਂ ਵਰਤ ਸਕਦੇ ਹਾਂ ਅਤੇ ਕਿਸੇ ਵੀ ਟਾਈਮ ਅੰਦਰ ਬਾਹਰ ਅਤੇ ਸਾਨੂੰ ਨਾ ਹੁਣ ਕਿਸੇ ਨੂੰ ਵੀ ਮਤਲਬ ਕੋਈ ਵੀ ਇੱਥੇ ਦਿੱਕਤ ਨਹੀਂ ਆਉਂਦੀ ਆਹ ਸਮੇਂ ਪਬਲਿਕ ਲਈ ਹੋ ਬਣੇ ਹੋਏ ਹਨ ਅਤੇ ਅਸੀਂ ਇਸ ਦੀ ਸਭ ਤੋਂ ਜ਼ਿਆਦਾ ਵਰਤੋਂ ਕਰ ਸਕਦੇ ਹਾਂ